ਹੱਥੀਂ ਕੱਪੜਿਆਂ ਦੇ ਸਿਊਤਿਆਂ 'ਚ ਅਤੇ ਰੈਡੀਮੇਂਟ ਸਿਊਤਿਆਂ 'ਚ ਬਹੁਤ ਫ਼ਰਕ ਹੁੰਦਾ ਉਹ ਛੇਤੀ ਫਟ ਜਾਂਦੇ ਆ ਉਹਨਾਂ ਦਾ ਰੰਗ ਫੇਟ ਹੋ ਜਾਂਦਾ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਦਸ ਰੇਡੀਮੇਟ ਕੱਪੜਿਆਂ ਦੇ ਵਾਸਤੇ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਜੋ ਦਰਜ਼ੀ ਤੋਂ ਸਿਲਾਏ ਹੁੰਦੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਹੰਢਦੇ ਆ ਉਹਨਾਂ ਦਾ ਰੰਗ ਵੀ ਨਹੀਂ ਫੇਟ ਹੁੰਦਾ ਅਤੇ ਉਹਨਾਂ ਵਿੱਚ ਸਾਨੂੰ ਕਲਰ ਮਨਪਸੰਦ ਮਿਲ ਜਾਂਦਾ ਕੱਪੜਾ ਬਹੁਤ ਵਧੀਆ ਮਿਲ ਜਾਂਦਾ ਮਨ ਅਸੀਂ ਆਪਣੇ ਪਸੰਦ ਦਾ ਕੱਪੜਾ ਖਰੀਦ ਕੇ ਲਿਆ ਸਕਦੇ ਹਾਂ ਅਤੇ ਉਹਨਾਂ 'ਤੇ ਜੋ ਫੁੱਲ ਬੂਟੀਆਂ ਪਾਉਣੀਆਂ ਹਨ ਉਹ ਪਾ ਸਕਦੇ ਹਾਂ ਅਤੇ ਜਿਵੇਂ ਚਾਹੇ ਫੀਟਿੰਗ ਦਾ ਸਿਲਾ ਸਕਦੇ ਹਾਂ ਅਤੇ ਉਹਨ ਉਹ ਸਾਡੀ ਪਸੰਦ ਦਾ ਵੀ ਮਿਲ ਜਾਂਦਾ ਅਤੇ ਕੱਪੜਾ ਵਧੀਆ ਹੰਢਦਾ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੀ ਸਬ ਸਿਲਾਈ ਕੀਤੀ ਜਾਂਦੀ ਹੈ ਅਤੇ ਰੈਡੀਮੇਟ ਕੱਪੜੇ 'ਤੇ ਬਹੁਤ ਮੋਟੇ ਮੋਟੇ ਤਰੀਕੇ ਨਾਲ ਸਿਉਤਾ ਜਾਂਦਾ ਅਤੇ ਉਹ ਛੇਤੀ ਫਟ ਜਾਂਦਾ ਅਤੇ ਉਹਨਾਂ 'ਚ ਸਾਨੂੰ ਕਲਰ ਵੀ ਨਹੀਂ ਮਨਪਸੰਦ ਮਿਲਦੇ ਅਤੇ ਉਹ ਕੱਪੜਾ ਵੀ ਨਹੀਂ ਚੰਗਾ ਹੁੰਦਾ ਅਤੇ ਉਹਦੇ ਵਿੱਚ ਫੀਟਿੰਗ ਵੀ ਨਹੀਂ ਕਈ ਵਾਰ ਸੈੱਟ ਬਹਿੰਦੀ ਅਤੇ ਉਹਦੇ ਵਿੱਚ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਚਾਹੇ ਰੈਡੀਮੇਡ ਕੱਪੜੇ ਦੀਆਂ ਫੈਕਟਰੀਆਂ ਬਹੁਤ ਵੱਡੀਆਂ ਵੱਡੀਆਂ ਖੁੱਲ੍ਹ ਗਈਆਂ ਪਰ ਲੋਕ ਐਂਨ ਦਰਜੀ ਤੋਂ ਸਿਲਾਏ ਕੱਪੜੇ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਉਹ ਵਧੀਆ ਉਹਨਾਂ ਦੀ ਫਿਟਿੰਗ ਹੁੰਦੀ ਹੈ ਜਾਂ ਉਹਨਾਂ ਨੂੰ ਦੁਬਾਰਾ ਉਦੇੜ ਕੇ ਵੀ ਅਸੀਂ ਸੈਟ ਕਰ ਸਕਦੇ ਹਾਂ ਅਤੇ ਰੈਡੀਮੇਟ ਕੱਪੜੇ ਵਿੱਚ ਦੁਬਾਰਾ ਅਸੀਂ ਸੈਟ ਨਹੀਂ ਕਰ ਸਕਦੇ ਨਾ ਹੀ ਉਹਨਾਂ ਦਾ ਕੱਪੜਾ ਸਹੀ ਹੁੰਦਾ ਅਤੇ ਹੱਥੀਂ ਬੁਣੇ ਕੱਪੜੇ ਨੂੰ ਅਸੀਂ ਵਾਰ ਵਾਰ ਸੈੱਟ ਕਰ ਸਕਦੇ ਹਾਂ ਤਾਂ ਉਹ ਵਧੀਆ ਤਰੀਕੇ ਨਾਲ ਹੰਢਦਾ ਅਤੇ ਗਰਮੀਆਂ ਵਿੱਚ ਕਾਟਨ ਦਾ ਕੱਪੜਾ ਖਰੀਦ ਸਕਦੇ ਹਾਂ ਅਤੇ ਸਰਦੀਆਂ ਵਿੱਚ ਮੋਟਾ ਕੱਪੜਾ ਖਰੀਦ ਸਕਦੇ ਹਾਂ ਇਸ ਕਰਕੇ ਰੈਡੀਮੇਟ ਕੱਪੜਾ ਅਤੇ ਆਮ ਸਿਲਾਏ ਕੱਪੜੇ ਵਿੱਚ ਫ਼ਰਕ ਹੁੰਦਾ ਕਿਉਂਕਿ ਉਹ 'ਚ ਅਸੀਂ ਆਪਣੀ ਪਸੰਦ ਦਾ ਸਿਲਾ ਸਕਦੇ ਹਾਂ ਆਪਣੀ ਪਸੰਦ ਦਾ ਕਲਰ ਲੈ ਸਕਦੇ ਹਾਂ ਅਤੇ ਰੈਡੀਮੇਟ ਵਿੱਚ ਅਸੀਂ ਇਹੋ ਜਿਹਾ ਕੁਛ ਨਹੀਂ ਕਰ ਸਕਦੇ